ਮੇਰੀ ਸਭ ਤੋਂ ਮਨ ਪਸੰਦ ਪੇਂਟਿੰਗ ਹੈ ਕਸ਼ਮੀਰ ਦੀ ਕਸ਼ਮੀਰ ਇੱਕ ਬਹੁਤ ਸੋਹਣੀ ਜਗ੍ਹਾ ਹੈ ਜਿੱਥੇ ਹਰਿਆਲੀ ਪਹਾੜ ਉੱਥੇ ਦੇ ਲੋਕ ਬਹੁਤ ਚੰਗੇ ਹਨ ਤੇ ਕਸ਼ਮੀਰ ਜਾਣਾ ਮੇਰੀ ਇੱਛਾ ਹੈ ਉਥੇ ਦਾ ਪਾਣੀ ਵੀ ਬਹੁਤ ਸਾਫ ਹੈ ਲੋਕੀ ਦੂਰੋਂ ਦੂਰੋਂ ਟੂਰਿਸਟ ਕਸ਼ਮੀਰ ਘੁੰਮਨ ਆਉਂਦੇ ਹਨ ਉਥੇ ਦੀ ਖੂਬਸੂਰਤੀ ਦੇਖਣ ਲਈ ਤੇ ਮੈਂ ਵੀ ਉੱਥੇ ਜਾਣਾ ਚਾਹੂੰਗੀ ਕਸ਼ਮੀਰ ਦੇ ਵਿੱਚ ਇੱਕ ਸ਼੍ਰੀਨਗਰ ਸ਼ਹਿਰ ਹੈ ਜੋ ਬਹੁਤ ਸੋਹਨਾ ਹੈ ਉਹ ਮੈਂ ਫੋਟੋਆਂ ਵਿੱਚ ਦੇਖਦੀ ਸੀ ਤੇ ਮੈਨੂੰ ਬਹੁਤ ਸੋਹਣਾ ਲੱਗਦਾ ਸੀ ਤੇ ਮੈਂ ਹੁਣ ਚਾਹੁੰਦੀ ਵੀ ਆ ਮੇਰੀ ਇੱਛਾ ਵੀ ਹੈ ਕਿ ਮੈਂ ਕਸ਼ਮੀਰ ਘੁੰਮਣ ਜਾਵਾਂ ਆਪਣੇ ਪਰਿਵਾਰ ਨਾਲ